ਕਿ ਮੈਂ ਮਾਰਕੀਟ ਤੋਂ ਇੱਕ ਸ਼ਲਟ ਖਰੀਦੀ ਕਿ ਜਦੋਂ ਮੈਂ ਪਹਿਨੀ ਤਾਂ ਮੇਰੇ ਪਿੰਡੇ ਨੂੰ ਵੀ ਰੰਗ ਲੱਗਣ ਲੱਗ ਗਿਆ ਕਿ ਜੋ ਕਿ ਇਹ ਕੱਚੇ ਰੰਗ ਦੀ ਹੈ ਜਦੋਂ ਇਸ ਨੂੰ ਪਾਣੀ ਵਿੱਚ ਆਪਾਂ ਧੋ ਧੋਤੀ ਹੈ ਤਾਂ ਇਹਦਾ ਰੰਗ ਬਿਲਕੁਲ ਬੇਕਾਰ ਹੋ ਗਿਆ ਮੈਂ ਇਸਨੂੰ ਦੁਬਾਰਾ ਪਾਉਣ ਲਈ ਨਹੀਂ ਪਸੰਦ ਕੀਤਾ